ਪੰਜਾਬੀ ਭਾਸ਼ਾ ਦੀਆਂ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਹਨ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨ ਲੱਗਿਆਂ ਪੰਜਾਬੀ ਭਾਸ਼ਾ ਜਿਹੜੀ ਇਹ ਉੱਨੀ ਸੌ ਸਤਾਹਠ ਦੇ ਵਿੱਚ ਹੋਂਦ ਦੇ ਵਿੱਚ ਆਈ ਸੀ ਅਤੇ ਇਹਨੂੰ ਲਾਗੂ ਕੀਤਾ ਗਿਆ ਸੀ ਉੱਨੀ ਸੌ ਅਠਾਹਠ ਦੇ ਵਿੱਚ ਜਦੋਂ ਨਵਾਂ ਪੰਜਾਬ ਹੋਂਦ ਦੇ ਵਿੱਚ ਆਇਆ ਸੀ ਪਰੰਤੂ ਜਿਹੜੀ ਇਹ ਪੰਜਾਬੀ ਭਾਸ਼ਾ ਆਪਣੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਚ ਉੱਨੀ ਸੌ ਬਾਨਵੇਂ ਦੇ ਵਿੱਚ ਲਾਗੂ ਕੀਤੀ ਗਈ ਸੀ ਉਦੋਂ ਬੱਚਿਆਂ ਨੂੰ ਇਹ ਜ਼ਰੂਰੀ ਕੀਤਾ ਗਿਆ ਸੀ ਕਿ ਪੰਜਾਬੀ ਆਪਣੀ ਮਾਤ ਭਾਸ਼ਾ ਹੈ ਅਤੇ ਇਹਨੂੰ ਬੋਲਣਾ ਜ਼ਰੂਰੀ ਹੈ ਇਹ ਪੰਜਾਬੀ ਭਾਸ਼ਾ ਨੂੰ ਪੰਜਾਬੀ ਦਾ ਇੱਕ ਸਬਜੈਕਟ ਵੀ ਲਾਜ਼ਮੀ ਬਣਾਇਆ ਗਿਆ ਜਿਸ ਦੇ ਨਾਲ ਬੱਚੇ ਆਪਣੇ ਮਾਤ ਭਾਸ਼ਾ ਦੇ ਨਾਲ ਜੁੜੇ ਰਹਿਣ ਪੰਜਾਬੀ ਭਾਸ਼ਾ ਕਈ ਦੇਸ਼ਾਂ ਦੇ ਵਿੱਚ ਬੋਲੀ ਜਾਂਦੀ ਹੈ ਪੰਜਾਬੀ ਭਾਸ਼ਾ ਦਾ ਕਈ ਦੇਸ਼ ਕਈ ਦੇਸ਼ਾਂ ਦੇ ਨਾਲ ਲਿੰਕ ਹੈ ਕਨੇਡਾ ਦੇ ਵਿੱਚ ਮੁੱਖ ਤੌਰ 'ਤੇ ਪੰਜਾਬੀ ਭਾਸ਼ਾ ਹੀ ਬੋਲੀ ਜਾਂਦੀ ਹੈ ਇੱਥੋਂ ਦੇ ਲੋਕ ਜਾ ਕੇ ਉੱਥੇ ਪੰਜ ਪੰਜਾਬ ਦੇ ਲੋਕ ਜਾ ਕੇ ਉੱਥੇ ਪੰਜਾਬੀ ਹੀ ਬੋਲਦੇ ਹਨ ਇਸ ਤੋਂ ਇਲਾਵਾ ਪੰਜਾਬ ਦਾ ਜਿਹੜਾ ਕਲਚਰ ਆ ਉਹ ਸਾਰਾ ਪੰਜਾਬੀ ਭਾਸ਼ਾ ਦੇ ਨਾਲ ਜੁੜਿਆ ਹੋਇਆ ਹੈ ਇਹਨਾਂ ਦਾ ਨਹੁੰ ਮਾਸ ਦਾ ਰਿਸ਼ਤਾ ਹੈ ਪੰਜਾਬ ਦੇ ਵਿੱਚ ਪੰਜਾਬ ਦਾ ਕਲਚਰ ਜਿਵੇਂ ਬੋਲੀਆਂ ਗਿੱਧਾ ਭੰਗੜਾ ਆਦਿ ਸਾਰਾ ਇਹ ਸਾਰੇ ਪੰਜਾਬੀ ਵਿੱਚ ਲਿਖੇ ਹੋਏ ਹਨ ਜੋ ਇਹਦੀ ਇਹਨੂੰ ਇਹਦੀ ਮਹੱਤਤਾ ਨੂੰ ਦਰਸਾਉਂਦੇ ਹਨ ਅਤੇ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਦੇ ਹਨ ਤਾਂ ਇਹ ਜੋ ਨੇ ਉਕਤ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਪੰਜਾਬੀ ਭਾਸ਼ਾ ਦੀਆਂ ਵਿਸ਼ੇਸ਼ਤਾਵਾਂ ਹਨ